ਪੰਜਾਬ ਵਿੱਚ ਜ਼ਿਆਦਾਤਰ ਸਾਰੇ ਪਰਿਵਾਰ ਵੱਡੇ ਹੀ ਹੁੰਦੇ ਆ ਅਤੇ ਸਾਰੇ ਹੀ ਮਤਲਬ ਜਿਵੇਂ ਇੱਕ ਪਰਿਵਾਰ 'ਚ ਚਾਚੇ ਤਾਏ ਸਾਰੇ ਹੀ ਆਪਣਾ ਇੱਕੋ ਛੱਤ ਥੱਲੇ ਇੱਕੋ ਚੁੱਲ੍ਹੇ 'ਤੇ ਰੋਟੀ ਬਣਦੀ ਹੈ ਅਤੇ ਸਾਰੇ ਹੀ ਘੱਟੋ ਘੱਟ ਜੇ ਜ਼ਿਆਦਾ ਨਹੀਂ ਵੀਹ ਪੱਚੀ ਮੈਂਬਰ ਪਰਿਵਾਰ ਦੇ ਜਦੋਂ ਸ਼ਾਮ ਨੂੰ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਅਤੇ ਸ਼ਾਮ ਨੂੰ ਜਦ ਇਕੱਠੇ ਇੱਕੋ ਚੁੱਲ੍ਹੇ ਅੱਗੇ ਬੈਠਦੇ ਹਾਂ ਜਾਂ ਇੱਕੋ ਮੰਜੇ 'ਤੇ ਸੱਥ ਵਾਂਗੂੰ ਬੈਠਦੇ ਹਾਂ ਅਤੇ ਉਹ ਸਾਰੇ ਦਿਨ ਦੀ ਜੋ ਵੀ ਦਿਨ 'ਚ ਕੀਤਾ ਹੁੰਦਾ ਆਪਣਾ ਬੀਤਿਆ ਹੁੰਦਾ ਉਹ ਸਾਰਾ ਇੱਕ ਦੂਜੇ ਨੂੰ ਦੱਸ ਦਿੰਦੇ ਜਦੋਂ ਇੱਕ ਦੂਜੇ ਨੂੰ ਦਿਲ ਦੀਆਂ ਗੱਲਾਂ ਕਰਦੇ ਨੇ ਤਾਂ ਉਹਦੇ 'ਚ ਬਹੁਤ ਕੁਝ ਅਤੇ ਛੋਟੇ ਵੱਡੇ ਨੂੰ ਸਿੱਖਣ ਨੂੰ ਵੀ ਮਿਲਦਾ ਅਤੇ ਦਿਲ ਦਾ ਜਿਹੜਾ ਬੋਝ ਹੁੰਦਾ ਉਹ ਵੀ ਹਲਕਾ ਹੁੰਦਾ ਅਤੇ ਕਈ ਜਿਹੜੀਆਂ ਦਿਨ 'ਚ ਕਈ ਪ੍ਰੋਬਲਮ ਹੁੰਦੀਆਂ ਨੇ ਆਉਣ ਵਾਲੀਆਂ ਜਾਂ ਕੋਈ ਮਨ 'ਚ ਕੋਈ ਗੱਲ ਚਲਦੀ ਜਾਂ ਕੁਛ ਵੀ ਚੱਲਦਾ ਏ ਤਾਂ ਉਹ ਇੱਕ ਦੂਜੇ ਨਾਲ ਮਿਲ ਕੇ ਜਦ ਬੈਠਦੇ ਨੇ ਫਿਰ ਉਹਦੇ ਨਾਲ ਸ਼ੇਅਰ ਕਰਦੇ ਨੇ ਤਾਂ ਸਾਰੇ ਹੀ ਫੈਮਿਲੀ ਮਤਲਬ ਫਿਰ ਉਹ ਚੀਜ਼ ਦਾ ਹੱਲ ਕੱਢਣ 'ਚ ਮਦਦ ਕਰਦੀ ਆ ਅਤੇ ਇੱਕ ਦੂਜੇ ਦੇ ਸਹਾਈ ਹੁੰਦੇ ਨੇ ਅਤੇ ਐਵੇਂ ਸਾਰੇ ਇੱਕ ਦੂਜੇ ਨਾਲ ਜੁੜ ਕੇ ਮਿਲ ਬੈਠਦੇ ਨੇ ਅਤੇ ਵਧੀਆ ਤੋਂ ਵਧੀਆ ਆਪਣੇ ਰਿਵਿਊ ਦਿੰਦੇ ਨੇ ਆਪਣਾ ਗੱਲਾਂ ਬਾਤਾਂ ਕਰਦੇ